ਹੈਲੋ ਹੈਲੋ ਨਮਸਤੇ ਅਕਾਲਪੁਰ ਟੇਲਰ ਬੋਲ ਰਹੇ ਹੋ ਮੈਨੂੰ ਨਾ ਮੈਨੂੰ ਇੱਕ ਸੂਟ ਸਵਾਉਣਾ ਸੀਗਾ ਅਤੇ ਦਿਵਾਲੀ ਲਈ ਤੋਂ ਲਾਈਕ ਤੁਸੀਂ ਦੱਸ ਸਕਦੇ ਹੋ ਤੁਹਾਡੇ ਰੇਟਸ ਕਿਵੇਂ ਹੈ ਜਿਵੇਂ ਲਾਈਨਿੰਗ ਦੇ ਸੂਟ ਜਾਂ ਸਿੰਪਲ ਸੂਟ ਲਾਈਨਿੰਗ ਵਾਲਾ ਸੂਟ ਜਾਂ ਲੈਸ ਵਾਲੇ ਸੂਟ ਦਾ ਜਿਹੜੀ ਲੈਸ ਲੈਸ ਵਾਲਾ ਸੂਟ ਹੁੰਦਾ ਉਹਦਾ ਓਕੇ ਜਿਹੜੀ ਲੈਸ ਦੇ ਜਾਂ ਜਿਹੜੀ ਲਾਈਨਿੰਗ ਹੈ ਉਹ ਤੁਸੀਂ ਆਪਦੇ ਵੱਲੋਂ ਲਾ ਲਉਂਗੇ ਚੂਜ਼ ਕਰਕੇ ਜਾਂ ਸਾਨੂੰ ਮੈਂ ਮਤਲਬ ਦੇ ਕੇ ਜਾਵਾਂ

ਠੀਕ ਆ ਅਤੇ ਤੁਸੀਂ ਹਾਂਜੀ ਤੁਸੀਂ ਕਿਆ ਕਰ ਰਹੇ ਹੋ ਹਾਂਜੀ ਅਤੇ ਮੈਂ ਪੁੱਛਣਾ ਸੀਗਾ ਕਿ ਤੁਸੀਂ ਜਲਦੀ ਤੋਂ ਜਲਦੀ ਦੇ ਕਿੰਨੇ ਦਿਨਾਂ 'ਚ ਕਵਰ ਕਰ ਸਕਦੇ ਹੋ ਸੂਟ ਨੂੰ ਲਾਈਕ ਲਾਈਨਿੰਗ ਵਾਲਾ ਸੂਟ ਬਣਵਾਉਣਾ ਹੈ ਲਾਈਕ ਦਿਵਾਲੀ ਤੱਕ ਚਾਹੀਦਾ ਹੈ ਹੋਰ ਚਾ ਚਾਰ ਦਿਨ 'ਚ ਹੋ ਸਕਦਾ ਹੈ ਬਣ ਸਕਦਾ ਹੈ ਹਾਂਜੀ ਹਾਂਜੀ ਹਾਂਜੀ ਮੈਨੂੰ ਦਿਵਾਲੀ ਲਈ ਚਾਹੀਦਾ ਹੈ ਅਤੇ ਫਿਰ ਥੋੜ੍ਹਾ ਜਿਹਾ ਫਿਟਿੰਗ ਵਗੈਰਾ ਵੀ ਦੇਖਣੀ ਪਏਗੀ ਕਿਆ ਪਤਾ ਐਡਜਸਟਮੈਂਟ ਵਗੈਰਾ ਕਰਨੀ ਪਵੇ ਫਿਰ ਉਹਦੇ ਲਈ ਟਾਈਮ ਚਾਹੀਦਾ ਹੁੰਦਾ ਹੈਲੋ ਠੀਕ ਹੈ ਅਤੇ ਬਸ ਇਹੀ ਕਿ ਸੂਟ ਜਿਹੜਾ ਹੈ ਜਲਦੀ ਤੋਂ ਜਲਦੀ ਤਿਆਰ ਕਰ ਦੇ ਜਲਦੀ ਚਾਹੀਦਾ ਹੈ

ਹਾਂਜੀ ਨਹੀਂ ਤੁਹਾਡੇ ਕੋਲੋਂ ਨਹੀਂ ਸਵਾਇਆ ਹੈ ਪਹਿਲਾਂ ਕਦੇ ਫਸਟ ਟਾਈਮ ਹੈ ਠੀਕ ਹੈ ਮੈਂ ਠੀਕ ਹੈ ਉਹਨਾਂ ਤੋਂ ਫਿਰ ਮੈਂ ਐਡਰੈੱਸ ਵੀ ਉਹਨਾਂ ਤੋਂ ਹੀ ਲੈ ਲਉਂਗੀ ਜਾਂ ਉਹਨਾਂ ਨਾਲ ਹੀ ਆ ਜਾਉਂਗੀ ਪੋਸੀਬਲ ਹੋਇਆ ਤਾਂ ਹਾਂਜੀ ਸ਼ਾਮ ਤੱਕ ਦੇ ਜਾਵਾਂਗੀ ਓਕੇ